ਤੁਸੀਂ ਚੰਡੀਗੜ੍ਹ ਕਮਿਊਨੀਕੇਸ਼ਨ ਤੋਂ ਬੋਲਦੇ ਹੋ ਮੈਂ ਤੁਹਾਡੇ ਕੋਲੋਂ ਇਹ ਦੂਜੀ ਵਾਰ ਪ੍ਰੋਡਕਟ ਮੰਗਵਾਇਆ ਸੀ ਇਹ ਪਹਿਲੀ ਗੱਲ ਤਾਂ ਇਹਦੀ ਡਿਲੀਵਰੀ ਬਹੁਤ ਲੇਟ ਹੋਈ ਇਹਦਾ ਨਾ ਮੋਬਾਇਲ ਦੀ ਨਾ ਬੈਟਰੀ ਬੈਕਅਪ ਐਨਾ ਹੈ ਨਾ ਇਹਦੀ ਕੈਮਰੇ ਦੀ ਕਲੀਅਰੈਂਸ ਐਨੀ ਹੈ ਅਤੇ ਨਾ ਹੀ ਤੁਸੀਂ ਇਹਦਾ ਕੋਈ ਗਾਰਡ ਜਾਂ ਕੋਈ ਕਵਰ ਦਿੱਤਾ ਨਾਲ ਮੈਨੂੰ ਇਹ ਨਾ ਹੀ ਇੰਨਾ ਪਸੰਦ ਲੱਗਿਆ ਅਤੇ ਮੈਨੂੰ ਪ੍ਰੋਡਕਟ ਪਹਿਲੇ ਨਾਲੋਂ ਦੂਜਾ ਬਹੁਤ ਖਰਾਬ ਲੱਗਿਆ